ਘਰ ਵਿੱਚ ਖਾਣਾ ਪਕਾਉਂਦੇ ਸਮੇਂ ਐਲ ਪੀ ਜੀ ਦੀ ਸੁਰਕਸ਼ਾ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਿਲੰਡਰ ਨੂੰ ਹਮੇਸ਼ਾਂ ਖੁੱਲ੍ਹੀ ਹਵਾ ਵਾਲੀ ਜਗ੍ਹਾ 'ਤੇ ਰੱਖੋ ਉੱਥੇ ਨਾ ਰੱਖੋ ਜਿੱਥੇ ਹਵਾ ਨਹੀਂ ਜਾ ਸਕਦੀ ਇਸ ਨੂੰ ਬੰਦ ਜਗ੍ਹਾ ਜਾਂ ਫਿਰ ਐਸੀ ਜਗ੍ਹਾ 'ਤੇ ਨਾ ਰੱਖੋ ਜਿੱਥੇ ਅੱਗ ਲੱਗਣ ਦਾ ਖ਼ਤਰਾ ਹੋਵੇ ਦੂਜਾ ਸਿਲੰਡਰ ਨੂੰ ਸਿੱਧਾ ਖੜਾ ਰੱਖੋ ਲਿਟਿਆ ਹੋਇਆ ਨਹੀਂ ਇਸ ਨਾਲ ਗੈਸ ਲੀਕ ਹੋਣ ਦੇ ਖ਼ਤਰੇ ਘੱਟ ਜਾਂਦੇ ਹਨ ਗੈਸ ਸਟੋਪ ਨੂੰ ਸਲੰਡਰ ਨਾਲ ਜੋੜਨ ਵਾਲੀ ਪਾਈਪ ਚੈੱਕ ਕਰੋ ਕਿ ਉਹ ਸਹੀ ਹੈ ਜਾਂ ਫਿਰ ਕਿਤੋਂ ਕਟੀ ਤਾਂ ਫਟੀ ਨਹੀਂ ਅਗਰ ਪਾਈਪ ਖ਼ਰਾਬ ਹੈ ਤਾਂ ਉਸ ਨੂੰ ਬਦਲ ਦਿਓ ਚੂਲ੍ਹੇ ਜਲਾਉਂਦੇ ਸਮੇਂ ਪਹਿਲਾਂ ਮਾਚਿਸ ਜਲਾਓ ਫਿਰ ਚੂਲ੍ਹਾ ਆਨ ਕਰੋ ਇਸ ਨਾਲ ਅਚਾਨਕ ਅੱਗ ਲੱਗਣ ਦਾ ਖ਼ਤਰਾ ਘੱਟ ਜਾਂਦਾ ਹੈ ਖਾਣਾ ਪਕਾਉਂਦੇ ਸਮੇਂ ਹਮੇਸ਼ਾਂ ਧਿਆਨ ਰੱਖੋ ਅਗਰ ਗੈਸ ਲੀਕ ਹੋ ਰਹੀ ਹੈ ਤਾਂ ਤੁਰੰਤ ਚੁੱਲ੍ਹਾ ਬੰਦ ਕਰ ਦਿਓ ਔਰ ਸਲਿੰਡਰ ਦਾ ਰੈਗੂਲੇਟਰ ਬੰਦ ਕਰ ਦਿਓ ਖਿੜਕੀਆਂ ਅਤੇ ਦਰਵਾਜ਼ੇ ਖੋਲ੍ਹ ਦਿਓ ਤਾਂ ਕਿ ਹਵਾ ਬਾਹਰ ਜਾ ਸਕੇ ਸਿਲਿੰਡਰ ਨੂੰ ਰੈਗੂਲਰ ਚੈੱਕ ਕਰੋ ਕਿ ਉਸ ਵਿੱਚ ਗੈਸ ਕਿੰਨੀ ਹੈ ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਹੈ ਕਿ ਸਿਲੰਡਰ ਕਦੋਂ ਖ਼ਤਮ ਹੋਣਾ ਹੈ ਤੁਸੀਂ ਨਵਾਂ ਸਿਲਿੰਡਰ ਦੇ ਟਾਈਮ 'ਤੇ ਮੰਗਵਾ ਸਕੋ ਅਗਰ ਤੁਸੀਂ ਗੈਸ ਦੀ ਸਮੈਲ ਆ ਰਹੀ ਹੈ ਤਾਂ ਕੋਈ ਵੀ ਇਲੈਕਟਰਿਕ ਸਵਿੱਚ ਔਨ ਜਾਂ ਆਫ ਨਾ ਕਰਿਓ ਤੁਰੰਤ ਸਲੰਡਰ ਦਾ ਰੈਗੂਲੇਟਰ ਬੰਦ ਕਰ ਦਿਓ ਅਤੇ ਖਿੜਕੀਆਂ ਖੋਲ੍ਹ ਦਿਓ ਹੈਲਪ ਲਈ ਗੈਸ ਏਜੰਸੀ ਨੂੰ ਫੋਨ ਕਰੋ ਅਤੇ ਇਸ ਇਹ ਸਭ ਸਾਵਧਾਨੀਆਂ ਵਰਤ ਵਰਤ ਕੇ ਤੁਸੀਂ ਆਪ ਆਪਣੇ ਘਰ ਦੀ ਸੁਰਕਸ਼ਾ ਕਰ ਸਕਦੇ ਹੋ